ਹਾਂਜੀ ਕੌਣ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤਾਜ਼ੀ ਸਬਜ਼ੀ ਤਾਂ ਮਿਲਦੀ ਜੇ ਅਤੇ ਮੈਨੇ ਦਿਖਾਉਣਾ ਇੱਥੇ ਹਨੂੰਮਾਨ ਚੌਂਕ 'ਚ ਘੰਟੀ ਜੀ ਅਤੇ ਇੱਥੋਂ ਸਬਜ਼ੀਆਂ ਵੀ ਵਧੀਆ ਮਿਲਦੀਆਂ ਅਤੇ ਬਾਕੀ ਜੇ ਥੋੜ੍ਹੀਆਂ ਸਸਤੀਆਂ ਲੈਣੀਆਂ ਜੇ ਉਹ ਸੁੱਕੇ ਤਲਾਅ ਤੋਂ ਉੱਥੋਂ ਥੋੜ੍ਹੀਆਂ ਸਸਤੀਆਂ ਪਰ ਉੱਥੋਂ ਸਬਜ਼ੀ ਇੰਨੀ ਵਧੀਆ ਨਹੀਂ ਮਿਲਦੀ ਇੱਥੋਂ ਜ਼ਿਆਦਾ ਵਧੀਆ ਮਿਲਦੀਆਂ ਹਾਂ ਰੇਟ ਤਾਂ ਬਹੁਤ ਹੁੰਦਾ ਵਾ ਦੇਖੋ ਸਬਜ਼ੀਆਂ ਤਾਜ਼ੀਆਂ ਹੁੰਦੀਆਂ ਜੇ ਹਾਂ ਸਸਤੀ ਫਿਰ ਤੁਸੀਂ ਤੁਹਾਨੂੰ ਇੱਥੋਂ ਸੁੱਕੇ ਤਲਾਅ ਤੋਂ ਮਿਲ ਜੇ ਸਕਦੀਆਂ ਉੱਥੋਂ ਮਿਲ ਸਕਦੀਆਂ ਇੱਥੇ ਲੱਗਦੀ ਜੇ ਸੁੱਕੇ ਤਲਾਅ ਕਾਲੇਜ ਰੋਡ ਦੇ ਉੱਤੇ ਕਾਲੇਜ ਰੋਡ ਸੁੱਕਾ ਤਲਾਅ ਇੱਥੇ ਮੰਡੀ ਲੱਗਦੀ ਹੈ ਇੱਥੇ ਸ਼ਾਮ ਨੂੰ ਲੱਗਦੀਆਂ ਜੇ ਮੰਡੀ ਹਾਂਜੀ ਹਾਂਜੀ ਅਤੇ ਉੱਥੋਂ ਇੱਥੇ ਸੁੱਕੇ ਤਲਾਅ ਵੀ ਸ਼ਾਮ ਨੂੰ ਜੇ ਅਤੇ ਉੱਥੇ ਵੀ ਅਤੇ ਇਹ ਵਾ ਵੀ ਇੱਥੇ ਸਬਜ਼ੀਆਂ ਤਾਂ ਇੰਨੀਆਂ ਵਧੀਆਂ ਨਹੀਂ ਪਰ ਸਸਤੀਆਂ ਹੈਗੀਆਂ ਜੇ ਇੱਥੋਂ ਸਸਤੀਆਂ ਮਿਲਦੀਆਂ